ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਜ਼ਰੂਰ ਜੀ ਜ਼ਰੂਰ ਹੁਕਮ ਕਰੋ ਜੀ ਹਾਂ ਹਾਂ ਬਿਲਕੁਲ ਸਹੀ ਸਮੇਂ ਹੈ ਜੀ ਪੁੱਛੋ ਜੀ ਸਰ ਜਦੋਂ ਦਾ ਏਅਰਪੋਰਟ ਬਣਿਆ ਹੈ ਨਾ ਜੀ ਜਦੋਂ ਦਾ ਮਤਲਬ ਬਹੁਤ ਜ਼ਿਆਦਾ ਡਿਵੈਲਪਮੈਂਟ 'ਚ ਨਾ ਉਹ ਜਿਹੜੀ ਸਪੀਡ ਹੈ ਉਹ ਬਹੁਤ ਜ਼ਿਆਦਾ ਵੱਧ ਗਈ ਹੈ ਬਹੁਤ ਤੇਜ਼ੀ ਨਾਲ਼ ਡਿਵੈਲਪਮੈਂਟ ਹੋ ਰਹੀ ਹੈ ਅਤੇ ਬਹੁਤ ਜ਼ਿਆਦਾ ਜੀ ਸੌਖਾਲੀ ਹੋ ਗਈ ਜ਼ਿੰਦਗੀ ਜਮਾਂ ਹੀ ਮਤਲਬ ਹੁਣ ਜੀ ਟਰੇਨਾਂ ਦਾ ਵੇਟ ਨਹੀਂ ਕਰਨਾ ਪੈਂਦਾ ਜੀ ਬੰਬੇ ਵਗੈਰਾ ਜਾਣ ਵਾਸਤੇ ਸਿੱਧੀ ਫਲਾਈਟ ਫੜੀ ਦੀ ਹੈ ਇੱਥੋਂ ਅਤੇ ਆਪਣਾ ਬੰਬੇ ਉਤਾਰ ਦਿੰਦੀ ਹੈ ਦਿੱਲੀ ਜਾਣਾ ਹੋਵੇ ਜੀ ਪਹਿਲਾਂ ਹੁਣ ਅਸੀਂ ਸਾਡੇ ਜਿਵੇਂ ਸਾਰੇ ਰਿਸ਼ਤੇਦਾਰ ਕਨੇਡਾ ਹੈ ਜੀ ਹੁਣ ਉਹਨਾਂ ਨੂੰ ਲਿਜਾਣ ਵਾਸਤੇ ਸਾਨੂੰ ਦਿੱਲੀ ਜਾਣਾ ਪੈਂਦਾ ਹੁੰਦਾ ਤਾ ਹੁਣ ਜੇ ਸਿੱਧੀ ਫਲਾਈਟ ਕਰਾਉਂਦੇ ਹੈ ਆਪਣਾ ਇੱਥੇ ਚੰਡੀਗੜ੍ਹ ਉਤਰ ਜਾਂਦੇ ਹੈ ਜੀ ਸਾਡਾ ਤਾਂ ਮਤਲਬ ਬਹੁਤ ਜ਼ਿਆਦਾ ਸੌਖਾ ਹੋ ਗਿਆ ਜੀ ਉਹ ਸਾਡੀ ਜਿਹੜੀ ਵਾਟ ਸੀ ਦਿੱਲੀ ਤੱਕ ਦੀ ਉਹ ਸਾਰੀ ਕੱਟੀ ਗਈ ਤਾਂ ਬਹੁਤ ਜ਼ਿਆਦਾ ਅਸੀਂ ਤਾ ਸੌਖਾਲੇ ਹੋ ਗਏ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਜੀ ਪਹਿਲਾਂ ਨਾਲੋਂ ਨਾ ਜਿਵੇਂ ਹੁਣ ਇੱਕ ਤਾਂ ਜਿਵੇਂ ਟੂਰਿਸਟ ਵੀ ਥੋੜ੍ਹੇ ਜ਼ਿਆਦਾ ਆਉਣ ਲੱਗ ਗਏ ਬਾਹਰ ਦੇ ਲੋਕ ਨਾ ਥੋੜ੍ਹੇ ਜਿਹੇ ਜ਼ਿਆਦਾ ਆਉਣ ਲੱਗ ਗਏ ਉਹਦੇ ਕਰਕੇ ਨਾ ਜੀ ਜਿਹੜੀਆਂ ਇੱਥੇ ਦੀਆਂ ਜਿਹੜੇ ਸਮੋਲ ਬਿਜ਼ਨਸ ਸੀ ਜੀ ਛੋਟੇ ਮੋਟੇ ਕਾਰੋਬਾਰ ਸੀ ਦੁਕਾਨਾਂ ਦਕੁਨਾਂ ਸੀਗੀਆਂ ਉਹਨਾਂ 'ਚ ਵੀ ਮਤਲਬ ਉਨ੍ਹਾਂ ਦਾ ਬਹੁਤ ਜ਼ਿਆਦਾ ਵਧੀਆ ਇਨਕਮ ਜਨਰੇਟ ਹੋ ਗਈ ਜੀ ਬਹੁਤ ਜ਼ਿਆਦਾ ਉਹਨਾਂ ਨੂੰ ਫਾਇਦਾ ਹੋ ਗਿਆ ਹੋਟਲ ਵਗੈਰਾ ਜਿਹੜੇ ਸੀ ਜੀ ਉਹਨਾਂ ਦੀ ਵੀ ਮਤਲਬ ਬੁਕਿੰਗ ਹੁਣ ਫੁਲ ਹੀ ਰਹਿੰਦੀ ਹੈ ਏਅਰਪੋਰਟ ਤਾਂ ਜਦੋਂ ਦਾ ਬਣਿਆ ਹਾਂਜੀ ਹਾਂ ਜ਼ਰੂਰ ਹਾਂਜੀ ਹਾਂਜੀ ਹਾਂਜੀ ਆਹ ਇਹੀ ਹੈ ਜੀ ਮਤਲਬ ਜੋ ਵੀ ਸਰਕਾਰ ਨੇ ਕਰਿਆ ਆਹਾ ਉਹ ਬਹੁਤ ਜ਼ਿਆਦਾ ਵਧੀਆ ਜਿਹੜਾ ਸਟੈੱਪ ਚੁੱਕਿਆ ਗਿਆ ਸਰਕਾਰ ਵੱਲੋਂ ਬਸ ਹੁਣ ਤਾਂ ਸਾਡੀ ਇਹੀ ਡਿਮਾਂਡ ਸੀ ਜੀ ਮਤਲਬ ਇੱਥੋਂ ਨਾ ਹੁਣ ਥੋੜ੍ਹੀਆਂ ਜਿਹੀਆਂ ਜਿਹੜੀ ਫਲਾਇਟਾਂ ਹੈ ਉਹ ਥੋੜ੍ਹੇ ਜਿਹੇ ਮਤਲਬ ਮੇਨ ਜਿਹੜੀ ਮੇਜਰ ਸਿਟੀਜ਼ ਹੈ ਉਹਨਾਂ ਨਾਲ਼ ਕਨੈਕਟ ਹੋਈਏ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ